ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਵਿੱਚ ਕਲਾ ਅਤੇ ਸ਼ਿਲਪ ਬਾਰੇ ਹੈ ਨਾ ਕਿ ਕਲਾ ਅਤੇ ਸ਼ਿਲਪ ਦਾ ਉਦਯੋਗਾਂ ਨਾਲ ਕੀ ਸੰਬੰਧ ਹੈ ਜੇ ਆਪਾਂ ਪੰਜਾਬ 'ਚ ਕਲਾ ਅਤੇ ਸ਼ਿਲਪ ਦੀ ਗੱਲ ਕਰੀਏ ਪੰਜਾਬ ਨੂੰ ਤਾਂ ਹੈ ਹੀ ਰੱਬੀ ਬਖਸ਼ਿਸ਼ ਏ ਨਾ ਕਲਾ ਦੀ ਜਾਂ ਸ਼ਿਲਪ ਦੀ ਕਿਉਂਕਿ ਸ਼ਿਲਪ ਇੱਕ ਕਿਸਮ ਦੀ ਕਿਰਤ ਹੋ ਗਈ ਸੱਤਿਆ ਸਾਡੇ ਬਾਬਾ ਨਾਨਕ ਜੀ ਉਹਨਾਂ ਨੇ ਤਾਂ ਕਿਹਾ ਸਾਨੂੰ ਕਿਰਤ ਕਰਨ ਨੂੰ ਹੈ ਅਤੇ ਕਲਾ ਕੁਛ ਵੀ ਹੋ ਸਕਦੀ ਹੈ ਤੁਹਾਡੀ ਲਿਖਣ ਦੀ ਕਲਾ ਤੁਹਾਡੀ ਨ ਨੱਚਣ ਦੀ ਕਲਾ ਹੈ ਨਾ ਤੁਹਾਡੀ ਗਾਉਣ ਦੀ ਕਲਾ ਅਤੇ ਸ਼ਿਲਪ ਹੋ ਜਾਂਦਾ ਆਪਣੇ ਹੱਥਾਂ ਦੀ ਕਲਾ ਜਿਹਦੇ ਵਿੱਚ ਆਪਾਂ ਕੁਛ ਵੀ ਲਾ ਲਓ ਜਾਂ ਕੋਈ ਡਿਜ਼ਾਇਨ ਤਿਆਰ ਕਰਨਾ ਕੋਈ ਕਢਾਈ ਦਾ ਤਿਆਰ ਕਰਨਾ ਕੋਈ ਸੂਟ ਤਿਆਰ ਕਰਨੇ ਆ ਹੈ ਨਾ ਕੋਈ ਦਰੀਆਂ ਜਾਂ ਕੁਛ ਵੀ ਤਿਆਰ ਕਰਨਾ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਇਹ ਉਦਯੋਗ ਨਾਲ ਵੱਖ ਨਹੀਂ ਕੀਤੀਆਂ ਜਾ ਸਕਦੀਆਂ ਉਦਯੋਗਾ ਤੋਂ ਕਿਉਂਕਿ ਉਦਯੋਗ ਨੇ ਜਿਹੜੇ ਇਹ ਇਹ ਚਲਦੇ ਹੀ ਕਲਾ ਦੇ ਸਹਾਰੇ ਨੇ ਜਿੰਨੀ ਜੇ ਤੁਹਾਡੀ ਕਲਾ ਸਾਹਮਣੇ ਆਉਂਦੀ ਹੈ ਤਾਂ ਹੀ ਇਹ ਉਦਯੋਗ ਅੱਗੇ ਵੱਧਦੇ ਨੇ ਅਤੇ ਉਦਯੋਗ ਉਨਾਂ ਚਿਰ ਹੀ ਉਦੋਂ ਹੀ ਤਰੱਕੀ ਕਰਨਗੇ ਜਿੰਨੀ ਵਧੀਆ ਤੁਸੀਂ ਉਸਨੂੰ ਮਸ਼ਹੂਰੀ ਦੇ ਰੂਪ 'ਚ ਪੇਸ਼ ਕਰੋਗੇ ਜਿੰਨਾ ਵਧੀਆ ਤੁਸੀਂ ਇੱਕ ਮਸ਼ਹੂਰੀ ਕਰਨਾ ਵੀ ਇੱਕ ਕਲਾ ਹੈ ਨਾ ਜੇ ਤੁਸੀਂ ਉਸਨੂੰ ਵਧੀਆ ਤਰੀਕੇ ਨਾਲ ਪੇਸ਼ ਕਰਦੇ ਹਾਂ ਲੋਕਾਂ ਸਾਹਮਣੇ ਦਿਖਾਉਣੇ ਹੋ ਆਪਣੀ ਕਲਾ ਨੂੰ ਲੋਕਾਂ ਸਾਹਮਣੇ ਪੇਸ਼ ਕਰਦੇ ਹੋ ਤਾਂ ਉਨਾਂ ਹੀ ਵਧੀਆ ਤੁਹਾਡਾ ਉਦਯੋਗ ਆ ਜਿਹੜਾ ਉਹ ਅੱਗੇ ਵਧੇਗਾ ਚੱਲੇਗਾ ਲੋਕ ਪ੍ਰਭਾਵਿਤ ਹੋਣਗੇ ਤੁਹਾਡੀ ਉਸ ਇਸ਼ਤਿਹਾਰਬਾਜ਼ੀ ਤੋਂ ਤੁਹਾਡੀ ਉਹ ਕਲਾ ਨੂੰ ਦੇਖ ਕੇ ਹੈ ਨਾ ਤਾਂ ਉਨਾਂ ਹੀ ਵਧੀਆ ਉਦਯੋਗ ਤੁਹਾਡਾ ਚਲੇਗਾ ਤਾਂ ਆਪਾਂ ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਕਿ ਪੰਜਾਬ ਵਿੱਚ ਕਲਾ ਸ਼ਿਲਪ ਕਲਾ ਅਤੇ ਸ਼ਿਲਪ ਹੈ ਜਿਹੜੀ ਇਹਨੂੰ ਉਦਯੋਗਾਂ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਲਾ ਹੀ ਉਦਯੋਗਾਂ ਨੂੰ ਅੱਗੇ ਲੈ ਕੇ ਜਾਂਦੀ ਹੈ ਧੰਨਵਾਦ